ਭਾਰਤ ਦਾ ਸੱਭਿਆਚਾਰ ਬਹੁਤ ਹੀ ਵਧੀਆ ਹੈ ਜਿੱਥੇ ਕਿ ਬਹੁਤ ਵਧੀਆ ਤਰੀਕੇ ਨਾਲ ਭਾਵਨਾ ਨਾਲ ਪਿਆਰ ਨਾਲ ਰਹਿੰਦੇ ਹਨ ਅਤੇ ਇੱਥੇ ਸ਼ੀਤਲਾ ਮਾਤਾ ਦਾ ਮੱਥਾ ਟੇਕਦੇ ਨੇ ਅਤੇ ਬਹੁਤ ਮੇਲਾ ਲੱਗਦਾ ਹੈ ਬਹੁਤ ਜ਼ਿਆਦਾ ਜਾਂਦੇ ਨੇ ਇਸ ਨੂੰ ਬਹੁਤ ਮੰਨਦੇ ਨੇ ਬਹੁਤ ਹੋਰ ਵੀ ਬਹੁਤ ਤਿਉਹਾਰ ਨੇ ਜੋ ਭਾਰਤ ਨਾਲ ਸੰਬੰਧਿਤ ਹਨ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਉਂਦੇ ਨੇ ਇੱਕ ਇੱਕ ਭਾਵਨਾ ਨਾਲ ਹੋ ਕੇ ਜਿਵੇਂ ਮੁੰਡੇ ਦਾ ਵਿਆਹ ਹੁੰਦਾ ਹੈ ਤਾਂ ਜੋ ਮੁੰਡੇ ਦੀ ਮਾਂ ਹੁੰਦੀ ਹੈ ਉਹ ਮੁੰਡੇ ਦੇ ਲਾਵਾਂ ਫੇਰੇ ਨਹੀਂ ਦੇਖਦੀ ਤਾਂ ਉਸ ਤੋਂ ਬਾਅਦ ਜਦੋਂ ਸ਼ਾਮੀ ਮੁੰਡਾ ਵਿਆਹ ਘਰ ਆਉਂਦਾ ਹੈ ਅਤੇ ਉਸ ਦੀ ਮਾਤਾ ਉਸ ਤੋਂ ਪਾਣੀ ਵਾਰ ਕੇ ਪੀਂਦੀ ਹੈ ਇਸ ਤਰ੍ਹਾਂ ਬਹੁਤ ਤਰ੍ਹਾਂ ਵਧੀਆ ਰਸਮਾਂ ਮਨਾਈਆਂ ਜਾਂਦੀਆਂ ਹਨ ਅਤੇ ਹੋਰ ਵੀ ਤਿਉਹਾਰ ਹੁੰਦੇ ਨੇ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਰਲ਼ ਮਿਲ ਕੇ ਇੱਕ ਜਗ੍ਹਾ 'ਤੇ ਇਕੱਠੇ ਹੋ ਕੇ ਸਾਰੇ ਮਨਾਉਂਦੇ ਨੇ ਬਹੁਤ ਵਧੀਆ ਤਰੀਕੇ ਨਾਲ